ਕੱਪੜੇ 'ਤੇ ਡਿਜ਼ਾਈਨ ਅਤੇ ਪੈਟਰਨ ਲਈ ਸਾਨੂੰ ਪਹਿਲਾਂ ਕੱਪੜੇ ਦਾ ਚੁਣਾਵ ਕਰਨਾ ਪੈਂਦਾ ਹੈ ਫਿਰ ਉਸ 'ਤੇ ਡਿਜ਼ਾਇਨ ਅਤੇ ਪੈਟਰਨ ਬਣਾਇਆ ਜਾਂਦਾ ਹੈ ਇਸ ਵਿੱਚ ਮੇਰੀ ਔਨਲਾਈਨ ਮਦਦ ਮੈਂ ਇੰਸਟਾਗ੍ਰਾਮ ਤੋਂ ਲੈਂਦੀ ਹਾਂ ਉਸ 'ਤੇ ਇੱਕ ਬ੍ਰੈਂਡ ਸੂਟ ਦਾ ਪੇਜ ਬਣਿਆ ਹੋਇਆ ਹੈ ਜਿਸ 'ਚ ਮੈਨੂੰ ਕਈ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਕਿਸ ਤਰ੍ਹਾਂ ਡਿਜ਼ਾਇਨ ਅਤੇ ਪੈਟਰਨ ਲਿਆ ਜਾਂਦਾ ਹੈ ਇਸ ਤੋਂ ਮੈਨੂੰ ਪਤਾ ਲੱਗਦਾ ਹੈ ਅਤੇ ਮੈਂ ਕਈ ਪੈਸੇ ਵੀ ਕਮਾਉਂਦੀ ਹਾਂ ਇਸ ਵਿੱਚ ਮੇਰੇ ਮਾਤਾ ਜੀ ਵੀ ਮੇਰੀ ਬਹੁਤ ਸਹਾਇਤਾ ਕਰਦੇ ਹਨ